ਭੰਗੜਾ ਸਾਡੇ ਪੰਜਾਬ ਦਾ ਲੋਕ ਨਾਚ ਹੈਗਾ ਬਹੁਤ ਸਾਲਾਂ ਤੋਂ ਭੰਗੜਾ ਅਤੇ ਗਿੱਧਾ ਬਹੁਤ ਹੀ ਜ਼ਿਆਦਾ ਕਰਿਆ ਜਾਂਦਾ ਸੀ ਵਿਆਹਾਂ ਸ਼ਾਦੀਆਂ ਵਿੱਚ ਜਾਂ ਕਿਸੇ ਘਰ ਵਿੱਚ ਖੁਸ਼ੀ ਹੋਵੇ ਤਾਂ ਭੰਗੜਾ ਜ਼ਰੂਰ ਕਰਦੇ ਸੀ ਮੁੰਡੇ ਅਤੇ ਕੁੜੀਆਂ ਗਿੱਧਾਂ ਅਤੇ ਢੋਲ ਵਜਾ ਕੇ ਖੁਸ਼ੀ ਜਾਹਿਰ ਕਰਦੇ ਸੀਗੇ ਹੁਣ ਤਾਂ ਭੰਗੜਾ ਵੈਸੇ ਤਾਂ ਫਿਟਨੈਸ ਲਈ ਬਹੁਤ ਜ਼ਿਆਦਾ ਚੰਗਾ ਹੁੰਦਾ ਸੀਗਾ ਹੁਣ ਵੀ ਲੋਕ ਜਿਮ ਵਗੈਰਾ ਦੇ ਵਿੱਚ ਭੰਗੜਾ ਕਾਡੀਓ ਵੈਗਰਾ ਡਾਂਸ ਮਤਲਬ ਕਰਦੇ ਹੈਗੇ ਆ ਪੰਜਾਬ ਦੇ ਗੀਤਾਂ ਦੇ ਵਿੱਚ ਵੀ ਭੰਗੜਾ ਅਤੇ ਗਾਣਿਆਂ ਦੇ ਵਿੱਚ ਭੰਗੜਾ ਸਾਰੇ ਪਾਸੇ ਭੰਗੜਾ ਹੋ ਗਿਆ ਪਰ ਇਹ ਵਿੱਚ ਕੁ ਨੂੰ ਖੋਹ ਗਿਆ ਸੀਗਾ ਪੰਜਾਬ 'ਚੋਂ ਫਿਰ ਹੁਣ ਓ ਅੱਜ ਕੱਲ੍ਹ ਦੇ ਬੱਚਿਆਂ ਨੇ ਯੂਥਾਂ ਨੇ ਇਹਨੂੰ ਫਿਰ ਬੜਾਵਾ ਦਿੱਤਾ ਭੰਗੜਾ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰਸਿੱਧ ਹੋ ਗਿਆ ਭੰਗੜਾ ਇਹਦੇ ਵਿੱਚ ਬੱਚੇ ਆਪਣੇ ਵਿਆਹਾਂ ਦੀ ਸ਼ੋਭਾ ਬਣਾਉਣ ਵਾਸਤੇ ਭੰਗੜਾ ਵਾਲੇ ਕਲਾਕਾਰਾਂ ਨੂੰ ਲੈ ਕੇ ਜਾਣਾ ਪਸੰਦ ਕਰਦੇ ਆ